ਅਸੀਂ ਗੱਲ ਖੇਡਾਂ ਤੋਂ ਸ਼ੁਰੂ ਕਰਦੇ ਹਾਂ ਤਾਂ ਖੇਡਾਂ ਪੇਂਡੂ ਪੱਧਰ 'ਤੇ ਬਹੁਤ ਹੀ ਮਹੱਤਵ ਅਤੇ ਮਨੋਰੰਜਨ ਦਾ ਸਾਧਨ ਨੇ ਅਤੇ ਆਪਸੀ ਭਾਈਚਾਰਾ ਅਤੇ ਪਿਆਰ ਵਧਾਉਣ ਲਈ ਵੀ ਇਹ ਇੱਕ ਵਧੀਆ ਸਾਧਨ ਹੈ ਅਤੇ ਖੇਡਾਂ ਖੇਡਣ ਨਾਲ ਸਾਡਾ ਸਰੀਰ ਤੰਦਰੁਸਤ ਰਹਿੰਦਾ ਅਤੇ ਇਸ ਬਹਾਨੇ ਅਸੀਂ ਸਵੇਰੇ ਸ਼ਾਮ ਆਪਣੇ ਪਿੰਡ ਦੇ ਬੰਦਿਆਂ ਨੂੰ ਸਿਆਣਿਆਂ ਨੂੰ ਅਤੇ ਮੁੰਡਿਆਂ ਨੂੰ ਮਿਲਦੇ ਹਾਂ ਅਤੇ ਪਿਆਰ ਵੱਧਦਾ ਅਤੇ ਖੇਡਾਂ ਖੇਡਣ ਨਾਲ ਸਾਡਾ ਸਰੀਰ ਤੰਦਰੁਸਤ ਰਹਿੰਦਾ ਅਤੇ ਸਾਡਾ ਇਮਊਨਟੀ ਸਿਸਟਮ ਵੱਧਦਾ ਅਤੇ ਇਸ ਨਾਲ ਕੱਦ ਕਾਠ ਵਧੀਆ ਹੁੰਦਾ ਅਤੇ ਸਾਡਾ ਸਰੀਰ ਵੀ ਠੀਕ ਰਹਿੰਦਾ ਅਤੇ ਖੇਡਾਂ ਪੇਂਡੂ ਸੱਭਿਆਚਾਰ ਦਾ ਮੁੱਢ ਤੋਂ ਹਿੱਸਾ ਰਹੀਆਂ ਹਨ ਪੁਰਾਤਨ ਸਮੇਂ ਤੋਂ ਹੀ ਖੇਡਾਂ ਪਿੰਡ ਦਾ ਇੱਕ ਸਿਹਰਾ ਬਣ ਕੇ ਰਹੀਆਂ ਹਨ ਜਿਵੇਂ ਕਬੱਡੀ ਗੁੱਲੀ ਡੰਡਾ ਖੋ ਖੋ ਆਦਿ ਇੱਦਾਂ ਦੀਆਂ ਹੋਰ ਵੀ ਖੇਡਾਂ ਨੇ ਜੋ ਪੇਂਡੂ ਪੱਧਰ 'ਤੇ ਖੇਡੀਆਂ ਜਾਂਦੀਆਂ ਹਨ ਅਤੇ ਬਹੁਤ ਹੀ ਵਧੀਆ ਅਤੇ ਫਾਇਦੇਮੰਦ ਹੁੰਦੀਆਂ ਹਨ